ਹਾਂ ਮੈਂ ਨੇੜੇ ਹੋਸਪਿਟਲ ਵਿੱਚ ਭੀੜ ਦੇਖੀ ਸੀ ਜਿਸ ਦੇ ਕਾਰਨ ਸਭ ਬਹੁਤ ਪਰੇਸ਼ਾਨੀ ਹੁੰਦੀ ਹੈ ਅਤੇ ਲੋਕਾਂ ਨੂੰ ਬਹੁਤ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਕਈ ਵਾਰ ਇਸ ਦੇ ਨ ਨਤੀਜੇ ਬਹੁਤ ਮਾੜੇ ਨਿਕਲਦੇ ਹਨ ਅਤੇ ਲੋਕ ਹਸਪਤਾਲ ਵਿੱਚ ਦੂਰ ਦੂਰ ਤੋਂ ਆਉਂਦੇ ਹਨ ਅਤੇ ਜਿਸ ਕਾਰਨ ਉ ਉਹਨਾਂ ਨੂੰ ਭੀੜ ਕਾਰਨ ਵਾਪਸ ਘਰ ਜਾਣਾ ਪੈਂਦਾ ਹੈ ਅਤੇ ਹਸਪਤਾਲ ਵਿੱਚ ਵੀ ਜ਼ਿਆਦਾ ਭੀੜ ਹੋਣ ਕਰਕੇ ਮਰੀਜ਼ਾਂ ਨੂੰ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਕਿਸੇ ਵੀ ਏਮਰਜੈਂਸੀ ਦਾ ਦਵਾਈ ਦਾ ਦਾ ਇਲਾਜ ਕਰਵਾਉਣਾ ਹੁੰਦਾ ਹੈ ਪਰ ਭੀੜ ਕਾਰਨ ਉਹ ਲੇਟ ਜਾ ਲੇਟ ਹੋ ਜਾਂਦੇ ਹਨ ਜਿਸ ਕਾਰਨ ਉਸਦੀ ਬਿਮਾਰੀ ਦੀ ਵੱਧ ਜਾਂਦੀ ਹੈ ਅਤੇ ਉਸਨੂੰ ਬਹੁਤ ਤਕਲੀਫ ਹੁੰਦੀ ਹੈ ਅਤੇ ਜ਼ਿਆਦਾ ਭੀੜ ਕਾਰਨ ਹਸਪਤਾਲ ਵਿੱਚ ਰੋਣ ਰੋਲਾ ਵੀ ਤੂੰ ਬਹੁਤ ਹੁੰਦਾ ਹੈ ਜਿਸ ਕਰਕੇ ਉਹ ਦਾਖਲ ਅੰ ਮਰੀਜ਼ ਤੰਗ ਹੋ ਜਾਂਦੇ ਹਨ ਅਤੇ ਆਪਣੇ ਮਰੀ ਨੇੜੇ ਹਸਪਤਾਲ ਵਿੱਚ ਇਕ ਵਾਰ ਗਈ ਤਾਂ ਅੰਦਰ ਦੇਖਿਆ ਕਿ ਲੋਕ ਬਹੁਤ ਹੀ ਸਮੇਂ ਤੱਕ ਲਾਈਨਾਂ ਵਿੱਚ ਲੱਗੇ ਰਹਿੰਦੇ ਸਨ ਅਤੇ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸ ਹੋ ਜਾਂਦੇ ਹਨ ਇਹ ਜ਼ਿਆਦਾ ਭੀੜ ਹੋਣ ਨਾਲ ਲੋਕਾਂ ਦੀ ਬਿਮਾਰੀਆਂ ਫੈਲ ਜਾਂਦੀਆਂ ਹਨ ਅਤੇ ਜਿ ਹੋ ਕਾਰਨ ਉਸ ਨੂੰ ਬਿਮਾਰੀ ਮਰੀਜ਼ ਬਿਮਾਰ ਮਰੀਜ਼ ਅਤੇ ਪ੍ਰਜੁਗਾਂ ਬਜ਼ਰਗਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਕਈ ਵਾਰ ਜ਼ਿਆਦਾ ਲੰਮੀ ਲਾਈਨ ਕਰਕੇ ਮਰੀਜ਼ ਦੀ ਵਾਰੀ ਨਹੀਂ ਆਉਂਦੀ ਜਿਸ ਕਾਰਨ ਉਹਨਾਂ ਨੂੰ ਹੋਸਪਿਟਲ ਵਿੱਚ ਵਾਰ ਵਾਰ ਜਾਣਾ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਇਲਾਜ ਦਾ ਵੀ ਦੇਰ ਨਾਲ ਜਾਂਦੀ ਹੈ